ਕਿਸੇ ਵੀ ਰਾਜ ਅਤੇ ਦੇਸ਼ ਬਾਰੇ ਜਾਨਣ ਲਈ ਇੰਟਰਨੈਟ ਦੀ ਵਰਤੋਂ ਕੀਤੀ ਜਾ ਸਕਦੀ ਹੈ ਗੂਗਲ ਰਾਹੀਂ ਯੂਟਿਊਬ ਰਾਹੀਂ ਜਾਂ ਵਿਕੀਪੀਡੀਆ ਰਾਹੀਂ ਜੇ ਆਪਾਂ ਗੂਗਲ ਦੇ ਅੰਦਰ ਭਾਰਤ ਫੀਡ ਕਰਦੇ ਹਾਂ ਤਾਂ ਗੂਗਲ ਸਾਨੂੰ ਹਰ ਉਸ ਲਿੰਕ 'ਤੇ ਲੈ ਜਾਂਦਾ ਹੈ ਜਿੱਥੇ ਭਾਰਤ ਦੇ ਬਾਰੇ ਦੱਸਿਆ ਗਿਆ ਹੋਵੇ ਯੂਟਿਊਬ ਦੇ ਅੰਦਰ ਕਾਫੀ ਵੀਡੀਓਜ ਬਣੀਆਂ ਹੋਈਆਂ ਨੇ ਜੋ ਕਿ ਸਾਨੂੰ ਭਾਰਤ ਉਹਦੀ ਵਿਸ਼ੇਸ਼ਤਾ ਉਹਦੇ ਲੋਕ ਨਾਚ ਅਤੇ ਕਾਫੀ ਚੀਜ਼ਾਂ ਬਾਰੇ ਦੱਸਦੀਆਂ ਹਨ ਰਾਸ਼ਟਰੀ ਗੀਤ ਤੋਂ ਲੈ ਕੇ ਰਾਸ਼ਟਰੀ ਪਕਛੀ ਤੱਕ ਯੂਟਿਊਬ ਦੇ ਉੱਪਰ ਹਰ ਇੱਕ ਚੀਜ਼ ਬਾਰੇ ਵੀਡੀਓ ਬਣੀ ਹੋਈ ਹੈ ਇਸ ਦੇ ਨਾਲ ਲੋਕ ਜੋ ਕਿ ਬਾਹਰ ਵਾਲੇ ਦੇਸ਼ਾਂ ਦੇ ਵਿੱਚ ਰਹਿੰਦੇ ਨੇ ਉਹ ਵੀ ਇਸ ਇਨਫੋਰਮੇਸ਼ਨ ਬਾਰੇ ਜਾਣ ਸਕਦੇ ਨੇ ਇਸ ਤੋਂ ਬਾਅਦ ਵਿਕੀਪੀਡੀਆ ਸਾਈਟ 'ਤੇ ਵੀ ਭਾਰਤ ਦੇ ਉੱਪਰ ਕਾਫੀ ਇਨਫੋਰਮੇਸ਼ਨ ਰੱਖੀ ਗਈ ਹੈ ਜੇ ਕੋਈ ਭਾਰਤ ਦੇ ਬਾਰੇ ਜਾਣਨਾ ਚਾਹ ਰਿਹਾ ਹੈ ਤਾਂ ਫਿਰ ਉਹ ਵਿਕੀਪੀਡੀਆ 'ਤੇ ਜਾ ਕੇ ਉਸ ਨੂੰ ਲੱਭ ਸਕਦਾ ਹੈ ਵਿਕੀਪੀਡੀਆ ਦੇ ਅੰਦਰ ਹਰ ਰਾਜ ਬਾਰੇ ਬਹੁਤ ਕੁਛ ਦੱਸਿਆ ਗਿਆ ਹੈ ਜਿਵੇਂ ਕਿ ਜਿਵੇਂ ਕਿ ਪੰਜਾਬ ਦੇ ਅੰਦਰ ਕਿਸ ਤਰ੍ਹਾਂ ਦਾ ਖਾਣਾ ਖਾਧਾ ਜਾਂਦਾ ਹੈ ਕਿਸ ਤਰ੍ਹਾਂ ਦਾ ਖਾਣਾ ਲੋਕ ਪਸੰਦ ਕਰਦੇ ਹਨ ਅਤੇ ਉਹ ਕਿਸ ਤਰੀਕੇ ਨਾਲ ਰਹਿੰਦੇ ਹਨ ਇਸਨੂੰ ਲੈ ਕੇ ਹੋਰ ਵੀ ਬਹੁਤ ਕੁਛ ਦੱਸਿਆ ਗਿਆ ਹੈ ਜਿਵੇਂ ਕਿ ਭਾਰਤ ਦੇ ਅੰਦਰ ਕੀ ਕੀ ਉਪਲਬਧ ਹੈ ਸਾਰੇ ਰੀਸੋਰਸਿਸ ਅਤੇ ਹੋਰ ਵੀ ਬਹੁਤ ਕੁਛ